ਅੱਜ ਕੱਲ੍ਹ ਦੇ ਸਮੇਂ ਵਿੱਚ ਸਾਨੂੰ ਕਈ ਤਕਨੀਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਚਾਹੁੰਦੀ ਹਾਂ ਕਿ ਅਜਿਹੇ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਅਤੇ ਇਹਨਾਂ ਨੂੰ ਦੂਰ ਕਰਨ ਲਈ ਲੋਕਾਂ ਦੀ ਮਦਦ ਕੀਤੀ ਜਾ ਸਕੇ ਸਭ ਤੋਂ ਪਹਿਲੀ ਸਮੱਸਿਆ ਮ ਸੰਬੰਧਿਤ ਜੁੜੀ ਹੈ ਪੇਸ਼ੇਵਰ ਪੇਸ਼ੇਵਰ ਲੋਕਾਂ ਦੀ ਜੋ ਕਿ ਮੁਹਾਰਤ ਹਾਸਲ ਕਰਦੇ ਹਨ ਪਰ ਉਹਨਾਂ ਦੀ ਬਹੁਤ ਸਾਰੀ ਮੰਗ ਘੱਟਦੀ ਜਾ ਰਹੀ ਹੈ ਲੋਕਾਂ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਵੱਧ ਤੋਂ ਵੱਧ ਇਸ ਇਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਨ ਪਰ ਮੁਹਾਰਤ ਨਾ ਹਾਸਲ ਹੋਣ ਕਰਕੇ ਉਹ ਇਹਨਾਂ ਪੇਸ਼ੇਵਰ ਪੇਸ਼ੇਵਰ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਹਨ ਇੰਟਰਨੈਟ ਦੀ ਸਮੱਸਿਆ ਇੰਨੀ ਕੁ ਵੱਧ ਚੁੱਕੀ ਹੈ ਲੋਕਾਂ ਨੂੰ ਇੰਨੀਆਂ ਕੁ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੈਂ ਚਾਹੁੰਦੀ ਹਾਂ ਕਿ ਸਰਕਾਰ ਨੂੰ ਵੀ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ ਅਤੇ ਤਕਨੀਕੀ ਵਾਤਾਵਰਨ ਵਿਚ ਸੁਧਾਰ ਲਿਆਉਣ ਅਤੇ ਨਵੀਨਤਾ ਵਿੱਚ ਲੋਕਾਂ ਨੂੰ ਪ੍ਰਣਾਲੀਆਂ ਸਿਖਾਉਣੀਆਂ ਚਾਹੀਦੀਆਂ ਹਨ ਤਾਂ ਕਿ ਲੋਕ ਅੱਜ ਕੱਲ੍ਹ ਦੇ ਤਕਨੀਕੀ ਯੁੱਗ ਵਿੱਚ ਉਹ ਇਹਨਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ ਜਿਵੇਂ ਕਿ ਹਰ ਸਮੱਸਿਆ ਦਾ ਹੱਲ ਕੋਈ ਨਿਊਜ਼ ਚੈਨਲਾਂ ਵਿੱਚ ਦਿਖਾਇਆ ਜਾਂਦਾ ਹੈ ਲੋਕ ਵੀਡੀਓ ਦੇਖ ਕੇ ਜਾਂ ਓਡੀਓ ਰਾਹੀਂ ਹੀ ਇਹਨਾਂ ਦਾ ਸ ਹੱਲ ਕਰਦੇ ਹਨ ਪਰ ਮੈਂ ਚਾਹੁੰਦੀ ਹਾਂ ਕਿ ਇਹ ਅਜਿਹੇ ਸਿੱਖਿਆ ਸਿਖਲਾਈ ਦਿੱਤੀ ਜਾਵੇ ਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਲੋਕ ਵੱਧ ਤੋਂ ਵੱਧ ਇਹਨਾਂ ਨੂੰ ਸਿੱਖ ਕੇ ਇਹਨਾਂ ਦਾ ਹੱਲ ਕਰ ਸਕਣ ਅਤੇ ਆਪਣੇ ਜੀਵਨ ਵਿੱਚ ਇਸ ਨੂੰ ਅਪਣਾ ਸਕਣ ਅਤੇ ਹਰੇਕ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਤਕਨੀਕੀ ਚੁਣੌਤੀਆਂ ਬਹੁਤ ਸਾਰੀਆਂ ਹਨ ਕਿਉਂਕਿ ਤਕਨੀਕੀ ਯੁੱਗ ਚੱਲ ਰਿਹਾ ਹੈ ਤਕਨੀਕੀ ਯੁੱਗ ਦੇ ਵਿੱਚ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਮ ਨਾਗਰਿਕ ਨੂੰ ਇਹਨਾਂ ਬਾਰੇ ਜਾਣਕਾਰੀ ਦੇਣ ਤਾਂ ਕਿ ਉਹ ਇਹਨਾਂ ਸਮੱਸਿਆਵਾਂ ਤੋਂ ਦੂਰ ਹੋ ਕੇ ਆਪਣੇ ਆਪ ਨੂੰ ਇੱਕ ਸੁਰੱਖਿਅਤ ਮਹਿਸੂਸ ਕਰ ਸਕਣ ਧੰਨਵਾਦ